ਪਹਿਲਾਂ ਤਾਂ ਮੈਨੂੰ ਘਰ ਦਾ ਬਣਿਆ ਭੋਜਨ ਹੀ ਪਸੰਦ ਹੈ ਜਿਵੇਂ ਕਿ ਸਰਦੀਆਂ ਵਿੱਚ ਤਿਲਾਂ ਦੀਆਂ ਪਿੰਨੀਆਂ ਖੋਆ ਸਾਗ ਪਰ ਇਹ ਸਾਰੀਆਂ ਚੀਜ਼ਾਂ ਘਰ 'ਚ ਹੀ ਬਣਨੀਆਂ ਚਾਹੀਦੀਆਂ ਕਿਉਂਕਿ ਬਜ਼ਾਰੂ ਮਠਿਆਈਆਂ ਵਿੱਚ ਬਹੁਤ ਮਿਲਾਵਟ ਹੁੰਦੀ ਹੈ ਇਸ ਕਰਕੇ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਥੋੜ੍ਹਾ ਟਾਈਮ ਕੱਢ ਕੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਘਰ 'ਚ ਬਣੀਆਂ ਚੀਜ਼ਾਂ ਹੀ ਖਿਲਾਓ ਜਿਵੇਂ ਕਿ ਸਾਡੀਆਂ ਦਾਦੀਆਂ ਨਾਨੀਆਂ ਮਾਵਾਂ ਬਣਾਉਂਦੀਆਂ ਸੀ ਘਰ ਵਿੱਚ ਬਣੇ ਸਾਗ ਅਤੇ ਅਤੇ ਮੱਕੀ ਦੀ ਰੋਟੀ ਉੱਪਰੋਂ ਮੱਖਣ ਅਤੇ ਲੱਸੀ ਦਾ ਆਨੰਦ ਹੀ ਵੱਖਰਾ ਹੈ ਬੱਚਿਆਂ ਨੂੰ ਵੀ ਇਹਨਾਂ ਘਰ ਵਿੱਚ ਬਣੀਆਂ ਵਸਤਾਂ ਨਾਲ ਜੋੜ ਕੇ ਰੱਖੋ ਕਿਉਂਕਿ ਅੱਜ ਕੱਲ੍ਹ ਤਾਂ ਬੱਚੇ ਬਜ਼ਾਰੂ ਚੀਜ਼ਾਂ ਪਸੰਦ ਕਰਦੇ ਨੇ ਪਰ ਅਸੀਂ ਉਹਨਾਂ ਨੂੰ ਪੁਰਾਣੇ ਵਿਰਸੇ ਨਾਲ ਜੋੜ ਕੇ ਰੱਖਣਾ ਹੈ ਮੈਨੂੰ ਭੋਜਨ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈਣਾ ਉਸਦਾ ਸ਼ੁਕਰਾਨਾ ਕਰਨਾ ਵਧੀਆ ਲੱਗਦਾ ਹੈ ਇਸ ਤਰ੍ਹਾਂ ਜਿਵੇਂ ਅਸੀਂ ਮਹਾਰਾਜ ਦਾ ਪ੍ਰਸ਼ਾ ਸ਼ੁਕਰਾਨਾ ਕਰਦੇ ਹਾਂ ਉਸੇ ਤਰ੍ਹਾਂ ਸਾਡੇ ਬੱਚੇ ਇਸ ਲਗਨ ਦੇ ਨਾਲ ਲੱਗਣਗੇ ਇਸੇ ਤਰ੍ਹਾਂ ਜਿਵੇਂ ਸਰਦੀਆਂ 'ਚ ਪਿੰਨੀਆਂ ਅਤੇ ਸਾਗ ਵਧੀਆ ਲੱਗਦਾ ਉਵੇਂ ਗਰਮੀਆਂ ਵਿੱਚ ਘਰ ਦੇ ਬਣੇ ਸ਼ਰਬਤ ਲੱਸੀ ਪੁਦੀਨੇ ਦੀ ਚਟਨੀ ਬਹੁਤ ਵਧੀਆ ਲੱਗਦੇ ਨੇ ਕਦੇ ਕਦੇ ਬਰਸਾਤਾਂ ਦੇ ਮੌਸਮ 'ਚ ਚਾਹ ਅਤੇ ਪਕੌੜੇ ਵਧੀਆ ਲੱਗਦੇ ਨੇ ਪਰ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਬਾਹਰ ਦੇ ਭੋਜਨ ਤੋਂ ਗੁਰੇਜ਼ ਕਰਨਾ ਚਾਹੀਦਾ